ਅੱਜ ਕੱਲ੍ਹ ਬੈਂਕਿੰਗ ਅਤੇ ਬੀਮਾ ਕੰ ਕੰਪਨੀ ਵਿੱਚ ਬਹੁਤ ਜ਼ਿਆਦਾ ਤਬਦੀਲੀਆਂ ਆ ਰਹੀਆਂ ਹਨ ਲੋਕਾਂ ਦਾ ਰੁਜ਼ਗਾਰ ਇਹਨਾਂ ਤੋਂ ਹੀ ਚੱਲ ਰਿਹਾ ਹੈ ਜੇਕਰ ਬੀਮਾ ਕੰਪਨੀਆਂ ਭਰੋਸੇਯੋਗ ਕੰਮ ਕਰਨਗੀਆਂ ਤਾਂ ਹੀ ਇਸਦਾ ਦਾਇਰਾ ਵੱਧ ਸਕਦਾ ਹੈ ਲੋਕ ਜ਼ਿਆਦਾ ਸਰਕਾਰੀ ਬੈਂਕਾਂ ਵਿੱਚ ਜਾਂ ਸਰਕਾਰੀ ਕੰਪਨੀਆਂ ਵਿੱਚ ਹੀ ਰੱਖਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਹਨਾਂ ਦੀ ਜੀਵਨ ਭਰ ਦੀ ਪੂੰਜੀ ਹੁੰਦੀ ਹੈ ਜੇਕਰ ਜੀਵਨ ਭਰ ਦੀ ਪੂ ਜੇ ਜੀ ਜੀਵਨ ਭਰ ਦੀ ਭਰ ਦੀ ਪੂੰਜੀ ਨੂੰ ਉਹ ਠੀਕ ਤਰੀਕੇ ਨਾਲ ਠੀਕ ਜਗ੍ਹਾ 'ਤੇ ਨਹੀਂ ਰੱਖਣਗੇ ਤਾਂ ਉਹਨਾਂ ਨੂੰ ਇਹ ਡਰ ਬਣਿਆ ਰਹੇਗਾ ਕਿ ਸਾਡੀ ਪੂੰਜੀ ਦਾ ਕੋਈ ਵੀ ਗਲਤ ਉਪਯੋਗ ਕਰ ਸਕਦਾ ਹੈ